ਟੈਕਨੋਲਜੀ ਦੇ ਆਉਣ ਤੋਂ ਪਹਿਲਾਂ ਕੀ ਸੀਗਾ ਕਿ ਹਰ ਇੱਕ ਬੰਦਾ ਕੋਈ ਵੀ ਤਰ੍ਹਾਂ ਦੀ ਜਿਹੜੀ ਕਲਾ ਹੁੰਦੀ ਆ ਉਹ ਆਪਣੇ ਹੱਥਾਂ ਨਾਲ ਆਪ ਤਿਆਰ ਕਰਦਾ ਸੀਗਾ ਪੂਰੀ ਮਿਹਨਤ ਕਰਦਾ ਸੀਗਾ ਘੰਟੇ ਘੰਟੇ ਉਹ ਜਿਹੜਾ ਸੀਗਾ ਉਸ ਚੀਜ਼ ਦੇ ਉੱਪਰ ਕੰਮ ਕਰਦਾ ਰਹਿੰਦਾ ਸੀਗਾ ਅਤੇ ਜਦੋਂ ਉਹ ਬਣ ਜਾਂਦੀ ਸੀ ਤਾਂ ਬਹੁਤ ਹੀ ਸੋਹਣੀ ਲੱਗਦੀ ਸੀ ਜਿਹੜੇ ਦਰਸ਼ਕ ਸੀਗੇ ਉਹਨਾਂ ਨੂੰ ਵੇਖ ਕੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਸੀ ਪਰ ਜਿਵੇਂ ਜਿਵੇਂ ਟਾਈਮ ਅੱਗੇ ਵਧਦਾ ਗਿਆ ਫੈਸਿਲਿਟੀਜ਼ ਵੱਧਦੀਆਂ ਗਈਆਂ ਟੈਕਨੋਲੋਜੀ ਦੇ ਵਿੱਚ ਵਾਧਾ ਹੋਇਆ ਜਿਹੜੀਆਂ ਕਲਾਵਾਂ ਵਾ ਉਹ ਵੀ ਡਿਜੀਟਲ ਦੇ ਡਿਜੀਟਲ ਰੂਪ ਦੇ ਵਿੱਚ ਜਿਹੜੀਆਂ ਵਾ ਉਹ ਸਾਹਮਣੇ ਆਉਣ ਲੱਗੀਆਂ ਅਤੇ ਉਹ ਇਸ ਤਰ੍ਹਾਂ ਹੋਇਆ ਵੀ ਜੋ ਅੱਜ ਕੱਲ੍ਹ ਦੇ ਬੱਚੇ ਆ ਉਹ ਕੀ ਹੋਇਆ ਵਾ ਆਮ ਜੋ ਹੱਧ ਹੱਥਾਂ ਨਾਲ ਬਣਾਈ ਹੋਈ ਕਲਾ ਵਾ ਉਹਨੂੰ ਵੇਖਣ ਨਾਲ ਨੂੰ ਜੋ ਡਿਜੀਟਲ ਕਲਾ ਹੈਗੀਆਂ ਵਾ ਉਹਨਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਆ ਅਤੇ ਉਹਨਾਂ ਨੂੰ ਜ਼ਿਆਦਾ ਵੇਖਣਾ ਪਸੰਦ ਕਰਦੇ ਆ ਇਸ ਕਰਕੇ ਕੀ ਹੋਇਆ ਵਾ ਕਿਤੇ ਨਾ ਕਿਤੇ ਜੋ ਲੋਕ ਹੱਥਾਂ ਨਾਲ ਪਹਿਲਾਂ ਕੰਮ ਕਰਦੇ ਸੀਗੇ ਉਹਦੀ ਜਗ੍ਹਾ ਅੱਜ ਕੱਲ੍ਹ ਜਿਹੜੀ ਆ ਉਹ ਡਿਜੀਟਲ ਕਲਾਵਾਂ ਨੇ ਜਿਹੜੀ ਉਹ ਲੈ ਲਈ ਆ ਅਤੇ ਲੋਕ ਜਿਹੜੇ ਆ ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਕੀ ਕਰਦੇ ਆ ਪੀ ਡਿਜੀਟਲ ਜਿਹੜੀ ਕਲਾ ਵਾ ਉਹਨਾਂ ਨੂੰ ਵੇਖਣਾ ਜਿਹੜਾ ਉਹ ਪਸੰਦ ਕਰਦੇ ਆ ਜੋ ਪਹਿਲਾਂ ਮਨੁੱਖ ਜਿਹੜੇ ਸੀਗੇ ਉਹ ਹੱਥਾਂ ਨਾਲ ਕੰਮ ਕਰਦੇ ਸੀਗੇ ਬੇਸ਼ੱਕ ਉਹ ਚੀਜ਼ਾਂ ਬਹੁਤ ਵਧੀਆ ਸੀਗੀਆਂ ਉਹ ਅੱਜ ਵੀ ਕਿਤੇ ਨਾ ਕਿਤੇ ਹੈਗੀਆਂ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅੱਜ ਵੀ ਜਿਹੜੇ ਲੋਕ ਉਹ ਹੱਥਾਂ ਨਾਲ ਵੱਖੋ ਵੱਖਰੀਆਂ ਚੀਜ਼ਾਂ ਜਿਹੜੀਆਂ ਉਹ ਬਣਾਉਂਦੇ ਆ ਪਰ ਜਿਹੜੇ ਅੱਜਕੱਲ੍ਹ ਦੇ ਲੋਕ ਆ ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਉਹ ਡਿਜੀਟਲ ਜਿਹੜੀਆਂ ਉਹ ਲੈਣਾ ਪਸੰਦ ਕਰਦੇ ਆ